ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸੁਖ ਆਨੰਦ ਇਨਫੋਟੈਕ ਬਰਨਾਲਾ ਤੋਂ ਗੱਲ ਕਰਦੇ ਹੋ ਹਾਂਜੀ ਹਾਂਜੀ ਅੱਛਾ ਸਰ ਤੁਸੀਂ ਪੀਐਮਕੇਵਾਈ ਦੇ ਜਿਹੜੇ ਕੋਰਸ ਹੈਗੇ ਪ੍ਰਧਾਨ ਮੰਤਰੀ ਵਾਲੇ ਉਹ ਸਾਰੇ ਹੈਗੇ ਆ ਤੁਹਾਡੇ ਕੋਲ ਅੱਛਾ ਅੱਛਾ ਠੀਕ ਹੈ ਹਾਂਜੀ ਸਰ ਮੈਂ ਨਾ ਜਿਹੜਾ ਬੇਸਕ ਹੁੰਦਾ ਕੰਪਿਊਟਰ ਦਾ ਇੱਕ ਸੌ ਵੀਹ ਘੰਟਿਆਂ ਵਾਲਾ ਅਤੇ ਉਹ ਕਰਨਾ ਚਾਹੁੰਦਾ ਗਾ ਹਾਂਜੀ ਅਤੇ ਉਹਦੇ ਵਾਸਤੇ ਮੈਨੂੰ ਇਹ ਦੱਸੋ ਕੀ ਮੈਂ ਕਰ ਸਕਦਾ ਗਾ ਹਾਂਜੀ ਮੈਂ ਪਲੱਸ ਟੂ ਕੀਤੀ ਹੋਈ ਹੈ ਜੀ ਨੰਬਰ ਮੇਰੇ ਪਝੱਤਰ ਪ੍ਰਸੈਂਟ ਹੈਗੇ ਜੀ ਹਾਂਜੀ ਹਾਂਜੀ ਨੰਬਰ ਪਝੱਤਰ ਪ੍ਰਸੈਂਟ ਹੈ ਹਾਂਜੀ ਮੈਂ ਪੇਂਡੂ ਖੇਤਰ ਤੋਂ ਹੀ ਕੀਤੀ ਸੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਹੈਗਾ ਜੀ ਪਿੰਡ ਜੀ ਪਿੰਡ ਖੂਡੀ ਖੁਰਦ ਜੀ ਅੱਛਾ ਅੱਛਾ ਹਾਂਜੀ ਸਰ ਹਾਂਜੀ ਮੈਂ ਆ ਹਾਂ ਠੀਕ ਹਾਂ ਜੀ ਮੈਂ ਆ ਜਾ ਸਕਦਾ ਵਧੀਆ ਹਾਂਜੀ ਸਰ ਟਾਈਮਿੰਗ ਕੀ ਹੋਵੇਗੀ ਅੱਛਾ ਇਕ ਘੰਟਾ ਲੱਗਿਆ ਕਰੇਗਾ ਜੀ ਡੇਲੀ ਅੱਛਾ ਅੱਛਾ ਠੀਕ ਹੈ ਸਰ ਹਾਂਜੀ ਹਾਂਜੀ ਸਰ ਫੀਸ ਕਿੰਨੀ ਹੈ ਅੱਛਾ ਫ੍ਰੀ ਹੁੰਦੇ ਆ ਜੀ ਇਹ ਪ੍ਰਧਾਨ ਮੰਤਰੀ ਓਕੇ ਓਕੇ ਓਕੇ ਸਰ ਥੈਂਕ ਯੂ ਜੀ ਸਰ ਜਦੋਂ ਇਹ ਮੈਂ ਕੋਰਸ ਪੂਰਾ ਕਰ ਲੂੰਗਾ ਕੀ ਮੈਨੂੰ ਕੋਈ ਇਹਦਾ ਸਰਟੀਫਿਕੇਟ ਵੀ ਦਿਓਗੇ ਤੁਸੀਂ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਸ ਜਿਹੜਾ ਇੱਕ ਸਰਟੀਫਿਕੇਟ ਆ ਇਹ ਕੋਰਸ ਪੂਰਾ ਪ੍ਰਵਾਣਿਤ ਹੋਊਗਾ ਜਾਨੀ ਕਿ ਪੀਐਮਕੇਬੀਬਾਈ ਦੇ ਨਾਲ ਅੱਛਾ ਅੱਛਾ ਠੀਕ ਹੈ ਜੀ ਅਤੇ ਜੇ ਮੈਂ ਕਿਸੇ ਨੌਕਰੀ ਦੇ ਲਈ ਅਪਲਾਈ ਕਰੂੰਗਾ ਕੀ ਇਹ ਜਿਹੜਾ ਕੋਰਸ ਹੈਗਾ ਉੱਥੇ ਮੰਨਿਆ ਜਾਵੇਗਾ ਅੱਛਾ ਠੀਕ ਹੈ ਜੀ ਅਤੇ ਬਸ ਤੁਹਾਡੇ ਕੋਲ ਹੀ ਕਰ ਸਕਦਾ ਇਹ ਮੈਂ ਕੋਰਸ ਆਪਣੇ ਸ਼ਹਿਰ ਦੇ ਵਿੱਚ ਮੈਨੂੰ ਉਹ ਨੇੜੇ ਤੇੜੇ ਕੋਈ ਹੋਰ ਹੋਵੇ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਸਾਡੇ ਪਿੰਡਾਂ 'ਚ ਤਾਂ ਨਹੀਂ ਕਰਾਉਂਦੇ ਚਲੋ ਬਰਨਾਲਾ ਸਾਨੂੰ ਨੇੜੇ ਹੀ ਹੈ ਜੀ ਚਲੋ ਮੈਂ ਤੁਹਾਡੇ ਨਾ ਇੱਥੇ ਹਾਂ ਠੀਕ ਹੈ ਸਰ ਹਾਂਜੀ ਅੱਛਾ ਜੀ ਦੋ ਤਾਂ ਮੈਂ ਫੋਟੋ ਕਾਪੀਆਂ ਲੈ ਕੇ ਆਉਣੀ ਸਰਟੀਫਿਕੇਟਸ ਦੀਆਂ ਠੀਕ ਹੈ ਜੀ ਆਧਾਰ ਕਾਰਡ ਹਾਂਜੀ ਹਾਂਜੀ ਆਧਾਰ ਕਾਰਡ ਦੀ ਫੋਟੋਕਾਪੀ ਲੈ ਆਉਗਾ ਜੀ ਅੱਛਾ ਜੀ ਇੱਕ ਮੇਰੀ ਪਾਸਪੋਰਟ ਹਾਂਜੀ ਸਰ ਮੈਂ ਸਾਰਾ ਕੁਛ ਲੈ ਕੇ ਨਾ ਤੁਹਾਡੇ ਔਫਿਸ ਦੇ ਵਿੱਚ ਆ ਆ ਜੂੰਗਾ ਕਿਰਪਾ ਕਰਕੇ ਮੈਨੂੰ ਜਿਹੜਾ ਇਹ ਕੋਰਸ ਹੈ ਨਾ ਪ੍ਰਧਾਨ ਮੰਤਰੀ ਦੁਆਰਾ ਚਲਾਇਆ ਗਿਆ ਤਾਂ ਮੈਨੂੰ ਇਹ ਜ਼ਰੂਰ ਕਰਵਾਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਜੀ ਮੈਂ ਥੈਂਕ ਯੂ ਜੀ